ਇਸ ਸੀਜ਼ਨ ਤਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਸੀਗੀ ਬਹੁਤ ਗਰਮੀ ਸੀਗੀ ਇਸ ਸੀਜ਼ਨ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਲੇਕਿਨ ਚਲੋ ਮੈਂ ਕਿਹਾ ਚਲੋ ਕਈ ਦੋ ਤਿੰਨ ਸਾਲ ਹੋ ਗਏ ਕਹਿੰਦੇ ਕਹਿੰਦੇ ਚਲੋ ਮਹਿੰਗਾ ਬਹੁਤ ਆ ਪਰ ਏ ਸੀ ਪਰ ਲਗਵਾ ਹੀ ਲੈਂਦੇ ਮਹਿੰਗਾ ਬਹੁਤ ਸੀਗਾ ਚਾਲੀ ਪੰਤਾਲੀ ਹਜ਼ਾਰ ਰੁਪਇਆ ਲੱਗ ਵੀ ਗਿਆ ਏ ਸੀ ਲਗਵਾ ਲਿਆ ਕੰਪਨੀ ਵੀ ਚਲੋ ਠੀਕ ਸੀਗੀ ਔਨਲਾਈਨ ਏ ਸੀ ਮੰਗਵਾ ਲਿਆ ਕੰਪਨੀ ਵਾਲੇ ਫਿੱਟ ਕਰਕੇ ਚਲੇ ਗਏ ਲੱਗੇ ਨੂੰ ਏ ਸੀ ਲਗਭਗ ਦੋ ਦੋ ਤਿੰਨ ਮਹੀਨੇ ਤੋਂ ਉੱਪਰ ਜ਼ਿਆਦਾ ਹੋ ਗਏ ਪਰ ਏ ਸੀ ਮੈਨੂੰ ਪਸੰਦ ਨਹੀਂ ਆਇਆ ਨਾ ਕੂਲਿੰਗ ਆ ਇਹਦੀ ਗੱਲ ਨਹੀਂ ਬਾਤ ਨਹੀਂ ਜੇ ਕੂਲਿੰਗ ਕਰਦਾ ਜ਼ਿਆਦਾ ਕਰ ਦਿੰਦਾ ਊਂ ਗਰਮ ਸਰਦ ਕਰ ਦਿੰਦਾ ਪ੍ਰੋਪਰ ਸਰਵਿਸ ਹੈ ਹੀ ਨਹੀਂ ਏ ਸੀ ਦੀ ਗੱਲਬਾਤ ਹੈ ਨਹੀਂ ਇਹ ਡੇਢ ਦੋ ਮਹੀਨੇ ਬਾਅਦ ਬਿ ਬਿੱਲ ਵੀ ਜਿਹੜਾ ਪਹਿਲਾ ਦੋ ਤਿੰਨ ਹਜ਼ਾਰ ਆਉਂਦਾ ਤਾ ਬਿੱਲ ਵੀ ਚਾਰ ਪੰਜ ਹਜ਼ਾਰ ਰੁਪਏ ਆ ਗਿਆ ਮਤਲਬ ਏ ਸੀ ਦਾ ਜਿਹੜਾ ਮੈਨੂੰ ਅਨੁਭਵ ਹੋਇਆ ਕੁਝ ਖਾਸ ਨਹੀਂ ਹੋਇਆ ਹੈਗਾ ਨਾ ਕੂਲਿੰਗ ਪ੍ਰੋਪਰ ਕਰਦਾ ਹੈ ਲਾਈਟ ਟਰਿੱਪ ਕਰੀ ਜਾਂਦੀ ਹੈ ਕਦੇ ਚਲਦਾ ਚਲਦਾ ਬੰਦ ਹੋ ਜਾਂਦਾ ਜਦੋਂ ਕੂਲਿੰਗ ਹੋਣ ਲੱਗਦੀ ਤਾਂ ਘਰੇ ਵੈਸੇ ਲਾਈਟ ਚਲੀ ਜਾਂਦੀ ਹੈ ਬਿਨਾਂ ਏ ਸੀ ਤੋਂ ਠੀਕ ਸੀਗੇ ਚਲੋ ਮਾੜਾ ਮੋਟਾ ਹੁਣ ਪੈਸੇ ਵੀ ਲੱਗ ਗਏ ਬਿੱਲ ਵੀ ਬਹੁਤ ਆ ਗਿਆ ਕੋਈ ਫਾਇਦਾ ਨਹੀਂ ਹੋਇਆ ਇੱਕ ਏ ਸੀ ਦੀ ਵੈਸੇ ਦਿੱਕਤ ਬਹੁਤ ਆਈ ਹੈ ਜਦੋਂ ਮੈਂਟੀਨੈਂਸ ਵਾਲਿਆਂ ਨੂੰ ਫੋਨ ਕਰਿਆ ਵੀ ਠੀਕ ਕਰਕੇ ਜਾਓ ਇਹਨੂੰ ਉਹ ਵੀ ਪ੍ਰੋਪਰ ਟਾਈਮ 'ਤੇ ਨਹੀਂ ਆਏ ਕਹਿੰਦੇ ਕੰਮ ਬਹੁਤ ਹੈ ਦੋ ਦਿਨ ਦੋ ਦਿਨ ਕਹਿ ਕੇ ਚਾਰ ਦਿਨ ਬਾਅਦ ਠੀਕ ਕਰਨ ਵਾਲੇ ਆਏ ਜਦੋਂ ਠੀਕ ਕਰ ਕੇ ਚਲੇ ਗਏ ਪੰਜ ਚਾਰ ਦਿਨ ਤਾਂ ਠੀਕ ਚੱਲਿਆ ਫੇਰ ਉਹੀ ਹਾਲ ਹੋ ਗਿਆ ਹੁਣ ਬੰਦ ਹੋਈ ਜਾਂਦਾ ਪ੍ਰੋਪਰ ਕੂਲਿੰਗ ਨਹੀਂ ਕਰਦਾ ਇੱਕ ਵੈਸੇ ਹੀ ਗਰਮੀ ਬਹੁਤ ਹੈ ਪਰ ਮੈਂ ਏ ਸੀ ਦਾ ਅਨੁਭਵ ਦਾ ਖੁਸ਼ ਨਹੀਂ ਹੋਇਆ ਜੀ ਲਵਾਇਆ ਵੀ ਪੈਸੇ ਵੀ ਲੱਗ ਗਏ ਪਰ ਮੇਰਾ ਇਹ ਜੋ ਏ ਸੀ ਦਾ ਅਨੁਭਵ ਜਿਹੜਾ ਐਕਸਪੀਰੀਅਸ ਆ ਨਿੱਲ ਰਿਹਾ ਬਿਲਕੁਲ ਜ਼ੀਰੋ ਰਿਹਾ